ਸ਼ੈਲੀਆਂ ਤਾਂ ਸਾਰੇ ਹੀ ਬਹੁਤ ਵਧੀਆ ਅਤੇ ਅੱਛੀਆਂ ਨੇ ਜਿਹੜੀ ਕਿ ਕਲਾਸੀਕਲ ਰੈਪ ਗੁਰਮਤ ਜਿਸਦੇ ਵਿੱਚੋਂ ਗੁਰਮਤਿ ਜਿਹੜੀ ਹੈ ਉਹ ਸਾਡੇ ਵਿਰਸੇ ਨਾਲ ਜੁੜੀ ਹੋਈ ਹੈ ਅਤੇ ਜਿਸ ਨੂੰ ਮੈਂ ਗੁਰੂ ਘਰ ਦੇ ਵਿੱਚ ਜਾ ਕੇ ਸ਼ਾਮ ਸਵੇਰੇ ਗਾਉਂਦਾ ਵੀ ਹਾਂ ਜਿਹਦੇ ਨਾਲ ਮੈਨੂੰ ਬਹੁਤ ਸਕੂਨ ਮਿਲਦਾ ਹੈ ਸਰੀਰ ਨੂੰ ਬਹੁਤ ਆਰਾਮ ਮਿਲਦਾ ਹੈ ਇੱਦਾਂ ਮਹਿਸੂਸ ਹੁੰਦਾ ਹੈ ਕਿ ਸਰੀਰ ਮੇਰਾ ਬਹੁਤ ਹਲਕਾ ਹੋ ਗਿਆ ਹੈ ਕੋਈ ਬਿਮਾਰੀ ਨਹੀਂ ਮੈਨੂੰ ਕੋਈ ਤਕਲੀਫ਼ ਨਹੀਂ ਮੈਨੂੰ ਇਹ ਸਾਡੇ ਵਿਰਸੇ 'ਚੋਂ ਸਾਨੂੰ ਮਿਲੀ ਹੈ ਇਸ ਕਰਕੇ ਸ਼ਾਇਦ ਮੈਂ ਇਸ ਦੇ ਨਾਲ ਜ਼ਿਆਦਾ ਰੁੱਝਿਆ ਜ਼ਿਆਦਾ ਜੁੜਿਆ ਅਤੇ ਮੈਂ ਇਸ ਨੂੰ ਗਾ ਕੇ ਇਹ ਅਰਦਾਸ ਪਰਮਾਤਮਾ ਦੇ ਅੱਗੇ ਭੇਟ ਕਰਕੇ ਮੈਨੂੰ ਇਹ ਮਹਿਸੂਸ ਹੁੰਦਾ ਕਿ ਮੇਰੇ ਸਾਰੇ ਦੁੱਖ ਤਕਲੀਫ਼ ਪਰਮਾਤਮਾ ਨੇ ਸਾਰੇ ਹੀ ਲੈ ਲਏ ਨੇ ਹਰ ਲਏ ਨੇ ਸੋ ਮੈਨੂੰ ਗੁਰਮਤਿ ਗਾ ਕੇ ਇੰਨਾ ਜ਼ਿਆਦਾ ਸਕੂਨ ਮਿਲਦਾ ਹੈ ਕਿ ਮੈਂ ਹਰੇਕ ਦੁੱਖ ਦਰਦ ਤੋਂ ਮੁਕਤ ਹਾਂ